ਵਿਦਿਆਰਥੀ ਦੂਜੇ ਕਸਬਿਆਂ ਦੇ ਸਕੂਲਾਂ ਜਾਂ ਹਾਈ ਸਕੂਲਾਂ ਵਿੱਚ ਜਾਣ ਦੇ ਲਈ ਜਾਂ ਤਾਂ ਪੈਦਲ ਜਾਂਦੇ ਹਨ ਜਾਂ ਆਪਣੇ ਨਿੱਜੀ ਸਾਈਕਲਾਂ ਦੀ ਵਰਤੋਂ ਕਰਦੇ ਹਨ ਇੱਥੇ ਕਿਸੇ ਵੀ ਤਰ੍ਹਾਂ ਦੀਆਂ ਨਿਯਮਿਤ ਬੱਸਾਂ ਜਾਂ ਵੈਨ ਕੋਈ ਵੀ ਨਹੀਂ ਲੱਗੀ ਹੋਈ ਉੱਚ ਗੁਣਵੱਤਾ ਵਾਲੀ ਜਿਹੜੀ ਪ੍ਰਾਇਮਰੀ ਸਿੱਖਿਆ ਪ੍ਰਾਪਤ ਕਰਨੀ ਬਹੁਤ ਹੀ ਔਖਾ ਕੰਮ ਹੈ ਕਿਉਂਕਿ ਵਿਦਿਆਰਥੀਆਂ ਕੋਲ ਬਹੁਤ ਜ਼ਿਆਦਾ ਸਾਧਨ ਨਹੀਂ ਹਨ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਹਨ ਜਿਵੇਂ ਕਿ ਮੌਸਮ ਖ਼ਰਾਬ ਹੋ ਜਾਂਦਾ ਹੈ ਤਾਂ ਵਿਦਿਆਰਥੀਆਂ ਦੇ ਲਈ ਬਹੁਤ ਹੀ ਦਿੱਕਤ ਆਉਂਦੀ ਹੈ ਬਹੁਤ ਜ਼ਿਆਦਾ ਮੀਂਹ ਦੇ ਵਿੱਚ ਵਿਦਿਆਰਥੀ ਸਕੂਲਾਂ ਦੇ ਵਿੱਚ ਜਦੋਂ ਜਾਂਦੇ ਹਨ ਤਾਂ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਹਨ ਉਹਨਾਂ ਕੋਲ ਸਾਰੇ ਸਾਧਨ ਮੌਜੂਦ ਨਹੀਂ ਹਨ ਜਿਸ ਕਰਕੇ ਇਹ ਵੀ ਬਹੁਤ ਦਿੱਕਤਾਂ ਆਉਂਦੀਆਂ ਹਨ ਬਹੁਤ ਜ਼ਿਆਦਾ ਗਰਮੀ ਦੇ ਸਮੇਂ ਦੇ ਵਿੱਚ ਸਕੂਲਾਂ ਦੇ ਵਿੱਚ ਅ ਇੰਨੇ ਜਿਹੜੇ ਸਾਧਨ ਨੇ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦੇ ਬਹੁਤ ਸਾਰੇ ਸਕੂਲਾਂ ਵਿੱਚ ਤਾਂ ਠੰਢੇ ਪਾਣੀ ਦੀ ਵਿਵਸਥਾ ਵੀ ਨਹੀਂ ਹੈ ਇਸ ਤੋਂ ਬਿਨਾਂ ਦਿੱਕਤਾਂ ਅ ਵੱਡੀਆਂ ਹਨ ਵਿਦਿਆਰਥੀ ਚੱਲ ਕੇ ਇੰਨੀ ਦੂਰ ਤੱਕ ਜਾਂਦੇ ਹਨ ਬਹੁਤ ਸਾਰੇ ਵਿਦਿਆਰਥੀ ਅਜਿਹੇ ਹੁੰਦੇ ਹਨ ਜੋ ਕਿ ਪਹੁੰਚਣ ਤੋਂ ਵੀ ਅਸਮਰਥ ਹੁੰਦੇ ਹਨ ਇੱਥੇ ਆ ਵੀ ਨਹੀਂ ਸਕਦੇ ਇੰਨੀ ਜਿਹੜੀ ਸਿੱਖਿਆ ਵੀ ਹਾਸਿਲ ਨਹੀਂ ਕਰ ਸਕਦੇ ਅਤੇ ਬਹੁਤ ਸਾਰੀਆਂ ਹੋਰ ਵੀ ਅਜਿਹੀਆਂ ਦਿੱਕਤਾਂ ਨੇ ਜਿਹਨਾਂ ਦੇ ਵਿੱਚ ਗਰੀਬੀ ਸਭ ਤੋਂ ਵੱਡੀ ਜਿਹੜੀ ਦਿੱਕਤ ਬਣਦੀ ਹੈ ਬਹੁਤ ਸਾਰੇ ਅਜਿਹੇ ਵਿਦਿਆਰਥੀ ਹਨ ਜਿਹੜੇ ਕਿ ਬਹੁਤ ਗਰੀਬ ਹੋਣ ਕਰਕੇ ਇਸ ਤਰ੍ਹਾਂ ਦੀ ਜਿਹੜੀ ਸਿੱਖਿਆ ਪ੍ਰਾਪਤ ਨਹੀਂ ਕਰ ਸਕਦੇ ਉਹਨਾਂ ਦੀ ਗਰੀਬੀ ਉਹਨਾਂ ਨੂੰ ਸਿੱਖਿਆ ਦੇ ਖੇਤਰ ਦੇ ਵਿੱਚ ਨਹੀਂ ਜਾਣ ਦਿੰਦੀ ਕਿਉਂਕਿ ਉਹ ਆਪਣਾ ਪੇਟ ਭਰਨ ਦੇ ਲਈ ਕੰਮ ਕਾਰ ਕਰਦੇ ਹਨ ਅਤੇ ਸਰਕਾਰਾਂ ਵੱਲੋਂ ਉਹਨਾਂ ਨੂੰ ਅਜਿਹੀਆਂ ਸਹੂਲਤਾਂ ਦੇਣ ਦੀ ਬਹੁਤ ਜ਼ਰੂਰਤ ਹੈ ਤਾਂ ਕਿ ਕੋਈ ਵੀ ਜਿਹੜਾ ਬੱਚਾ ਹੈ ਉਹ ਸਿੱਖਿਆ ਤੋਂ ਵਾਝਾਂ ਨਾ ਰਹਿ ਸਕੇ